ਸਾਡੇ ਘਰ ਡੰਗਰ ਤਾਂ ਨਹੀਂ ਹੈਗੇ ਪਰ ਅਸੀਂ ਦੇਖਿਆ ਹੈ ਕਿ ਇਹ ਗੁਆਂਢੀਆਂ ਦੇ ਕਿਸ ਤਰ੍ਹਾਂ ਇੱਕ ਨਵੇਂ ਜੰਮੇ ਬੱਚੇ ਨੂੰ ਪਾਲਦੇ ਨੇ ਉਹ ਨਵੇਂ ਨਵ ਜੰਮੇ ਬੱਚੇ ਦੇ ਸਮੇਂ ਸਿਰਫ ਟੀਕਾਕਰਨ ਕਰਵਾਉਂਦੇ ਨੇ ਅਤੇ ਉਸਦੇ ਦੁੱਧ ਦਾ ਬਹੁਤ ਧਿਆਨ ਰੱਖਦੇ ਨੇ ਉਸਨੂੰ ਤਿੰਨੇ ਟੈਮ ਦੁੱਧ ਦਿੱਤਾ ਜਾਂਦਾ ਹੈ ਤਿੰਨੇ ਟੈਮ ਦੁੱਧ ਦਿੱਤਾ ਜਾਂਦਾ ਹੈ ਅਤੇ ਉਸਨੂੰ ਇੱਕ ਖੁੱਲ੍ਹੇ ਵਾਤਾਵਰਣ ਦੇ ਵਿੱਚ ਰੱਖਿਆ ਜਾਂਦਾ ਹੈ ਉਹ ਪਾਣੀ ਉਸਨੂੰ ਪਾਣੀ ਸਮੇਂ ਸਿਰ ਪਿਆਇਆ ਜਾਂਦਾ ਹੈ ਤਾਂ ਜੋ ਉਹ ਬਿਮਾਰ ਨਾ ਹੋਵੇ ਉਸ ਨੂੰ ਸਰਦੀਆਂ ਵਿੱਚ ਸਰਦੀਆਂ ਵਿੱਚ ਠੰਡ ਤੋਂ ਬਚਾਉਣ ਲਈ ਉਸਨੂੰ ਲਪੇਟਿਆ ਜਾਂਦਾ ਹੈ ਲਪੇਟਿਆ ਜਾਂਦਾ ਹੈ ਤਾਂ ਜੋ ਉਸਨੂੰ ਠੰਡ ਨਾ ਲੱਗੇ ਉਸਨੂੰ ਬਰਸਾਤ ਵਿੱਚ ਬੜੇ ਹੀ ਬੜੇ ਹੀ ਆਰਾਮ ਨਾਲ ਰੱਖਿਆ ਜਾਂਦਾ ਹੈ